ਗਰੀਬੀ ਅਤੇ ਬੇਰੁਜ਼ਗਾਰੀ ਸਮਕਾਲੀ ਸਮੇਂ ਦੇ ਵਿੱਚ ਹਰ ਇੱਕ ਦੇਸ਼ ਲਈ ਹਰ ਇੱਕ ਖਿੱਤੇ ਲਈ ਜਿਹੜਾ ਵੱਡੀਆਂ ਬਿਮਾਰੀਆਂ ਬਣੀਆਂ ਹੋਈਆਂ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਗਰੀਬੀ ਅਤੇ ਬੇਰੁਜ਼ਗਾਰੀ ਸਮੱਸਿਆ ਹੈਗੀ ਹੈ ਇੱਕ ਵੱਡੀ ਸਮੱਸਿਆ ਪਰ ਇਹ ਸਮੱਸਿਆ ਕਿਉਂਕਿ ਪੰਜਾਬ ਨੂੰ ਖੇਤੀ ਪ੍ਰਧਾਨ ਸੂਬੇ ਦੇ ਤੌਰ 'ਤੇ ਜਾਣਿਆ ਜਾਂਦਾ ਤਾਂ ਹੁਣ ਖੇਤੀ ਦੇ ਵਿੱਚ ਵੀ ਜ਼ਿਆਦਾਤਰ ਮਸ਼ੀਨੀਕਰਨ ਦਾ ਵਾਧਾ ਹੋਣ ਕਰਕੇ ਇਹ ਜਿਹੜੀ ਸਮੱਸਿਆ ਜਿਹੜੀ ਥੋੜ੍ਹੀ ਜਿਹੀ ਵੱਧ ਚੱਲੀ ਹੈ ਤਾਂ ਇਹਦੇ ਨਾਲ ਹੀ ਜਿਹੜਾ ਇਹਦੇ ਜਿਹੜਾ ਇੱਕ ਕਾਰਨ ਵਿਦੇਸ਼ਾਂ ਵੱਲ ਜਾਣ ਦਾ ਪੰਜਾਬ 'ਚੋਂ ਪ੍ਰਵਾਸ ਦਾ ਜਿਹੜਾ ਕਾਰਨ ਉਹ ਵੀ ਇਹਦੇ ਨਾਲ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਪੰਜਾਬ ਵਿੱਚ ਪੜ੍ਹੇ ਲਿਖਿਆ ਦੀ ਗਿਣਤੀ ਹੈ ਜਿਹੜੀ ਉਹ ਪੜ੍ਹੇ ਲਿਖੇ ਨੌਜਵਾਨ ਬਹੁਤ ਜ਼ਿਆਦਾ ਨੇ ਚੰਗੀਆਂ ਡਿਗਰੀਆਂ ਹਾਸਲ ਨੌਜਵਾਨ ਨੇ ਤਾਂ ਸਰਕਾਰ ਉਨ੍ਹਾਂ ਲਈ ਜਿਹੜੀਆਂ ਵੱਖ ਵੱਖ ਖੇਤਰਾਂ ਵਿੱਚ ਨੌਕਰੀਆਂ ਆਉਂਦੀਆਂ ਜ਼ਰੂਰ ਨੇ ਸਰਕਾਰ ਦੁਆਰਾ ਕੱਢੀਆਂ ਵੀ ਜਾਂਦੀਆਂ ਨੇ ਪਰ ਇੱਕ ਉਹ ਜ਼ਿਆਦਾਤਰ ਉਨ੍ਹਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਬਹੁਤ ਲੰਬਾ ਹੋ ਜਾਂਦਾ ਜਿਹਦੇ ਕਾਰਨ ਇੱਕ ਕੋਈ ਭਰਤੀ ਆਈ ਤਾਂ ਉਹ ਜ਼ਿਆਦਾ ਸਮੇਂ ਤੱਕ ਬਿਨਾਂ ਪਾਰਦਰਸ਼ਤਾ ਤੋਂ ਜਿਹੜੀ ਉਹ ਲਟਕਦੀ ਰਹਿ ਜਾਂਦੀ ਆ ਤਾਂ ਸਰਕਾਰ ਨੂੰ ਇਹਦੇ ਲਈ ਇਹ ਸੁਝਾਅ ਵੀ ਹੈ ਕਿ ਇੱਕ ਤਾਂ ਹਰ ਇੱਕ ਜਿਹੜਾ ਖੇਤਰ ਦੇ ਵਿੱਚ ਉਹਦੇ ਵਿੱਚ ਰੁਜ ਰੋਜ਼ਗਾਰ ਪੈਦਾ ਕੀਤੇ ਜਾਣ ਤਾਂ ਜਿਹੜੀ ਉਚੇਰੀ ਸਿੱਖਿਆ ਉਚੇਰੀ ਸਿੱਖਿਆ ਦੇ ਨਾਲ ਨਾਲ ਜਿਹੜੀ ਇੱਕ ਵਕੇਸ਼ਨਲ ਜਾਂ ਕਿੱਤਾ ਮੁਖੀ ਸਿੱਖਿਆ ਉਹਨੂੰ ਵੀ ਸਰਕਾਰ ਜਿਹੜੀ ਉਹ ਪੈਦਾ ਕਰੇ ਤਾਂ ਕਿ ਸਰਕਾਰੀ ਖੇਤਰ ਦੇ ਵਿੱਚ ਨੌਕਰੀਆਂ ਜਾਣ ਨਾਲ ਜਿਹੜਾ ਵਿਦਿਆਰਥੀ ਕਿੱਤਾ ਮੁੱਖੀ ਸਿੱਖਿਆ ਹਾਸਲ ਕਰਕੇ ਆਪਣਾ ਵੀ ਜਿਹੜਾ ਕੋਈ ਰੁਜ਼ਗਾਰ ਦਾ ਸਾਧਨ ਉਹ ਚਲਾ ਚਲਾ ਸਕੇ